ਸਾਡੇ ਹਸਪਤਾਲਾਂ ਵਿੱਚ ਅੱਜ ਵੀ ਬਿਸਤਰੇ ਆਕਸੀਜਨ ਸਲੈਂਡਰ ਅਤੇ ਸਰਜੀਕਲ ਔਜ਼ਾਰਾਂ ਦੀ ਬਹੁਤ ਕਮੀ ਹੈ ਮੈਂ ਆਪਣੇ ਇੱਕ ਪਿੰਡ ਦੀ ਘਟਨਾ ਦਾ ਵਰਣਨ ਕਰਨਾ ਚਾਹੁੰਦੀ ਹਾਂ ਕਿਉਂਕਿ ਸਾਡੇ ਪਿੰਡ ਵਿੱਚ ਇੱਕ ਮਰੀਜ਼ ਦੀ ਬਹੁਤ ਹੀ ਸੀਰੀਅਸ ਹਾਲਾਤ ਜਦੋਂ ਉਸਨੂੰ ਹੋਸਪਿਟਲ ਵਿੱਚ ਲਿਜਾਇਆ ਗਿਆ ਤਾਂ ਉਸ ਦੀ ਹਾਲਾਤ ਬਹੁਤ ਹੀ ਗੰਭੀਰ ਸਨ ਉਸ ਨੂੰ ਹਸਪਤਾਲ ਵਿੱਚ ਬੈਡ ਨਹੀਂ ਮਿਲਿਆ ਅਤੇ ਨਾ ਹੀ ਉਸਨੂੰ ਕੋਈ ਵੀ ਵਧੀਆ ਡਾਕਟਰ ਮਿਲਿਆ ਕਿਉਂਕਿ ਉਸ ਸਮੇਂ ਕਰੋਨਾ ਕਾਲ ਸੀ ਕਰੋਨਾ ਕਾਲ ਵਿੱਚ ਬਹੁਤ ਹੀ ਲੋਕਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਅੱਜ ਵੀ ਹਸਪਤਾਲਾਂ ਵਿੱਚ ਬਹੁਤ ਹੀ ਕਮੀ ਹੈ ਕੋਈ ਚੰਗੇ ਔਜ਼ਾਰ ਨਹੀਂ ਅਤੇ ਨਾ ਹੀ ਚੰਗੇ ਬਿਸਤਰੇ ਮਿਲਦੇ ਹਨ ਅਤੇ ਹਸਪਤਾਲਾਂ ਵਿੱਚ ਅੱਜ ਵੀ ਇਸ ਚੀਜ਼ ਦੀ ਬਹੁਤ ਕਮੀ ਹੈ ਹਸਪਤਾਲਾਂ ਵਿੱਚ ਸਿਲਿੰਡਰਾਂ ਦੀ ਵੀ ਬਹੁਤ ਕਮੀ ਹੈ ਇਸ ਕਰਕੇ ਸਾਨੂੰ ਅੱਜ ਇਸ ਨਾਕਾਮੀ ਦਾ ਸਾਹਮਣਾ ਕਰਨਾ ਪਿਆ